ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਇੱਥੋਂ ਈਸਾ ਨਗਰੀ ਦੀ ਪੁਲੀ ਤੋਂ ਬੋਲਿਆ ਵਾ ਜੀ ਪਿਛਲੇ ਦਿਨੀਂ ਮੈਨੂੰ ਆਪਣੇ ਘਰ ਤੋਂ ਕਿਸੇ ਜ਼ਰੂਰੀ ਕੰਮ ਲਈ ਬਾਹਰ ਜਾਣਾ ਪੈ ਗਿਆ ਜਦੋਂ ਮੈਂ ਵਾਪਸੀ 'ਤੇ ਆਪਣੇ ਪਰਿਵਾਰ ਸਮੇਤ ਆਇਆ ਤਾਂ ਦੇਖਿਆ ਕਿ ਘਰ ਦੇ ਵਿੱਚੋਂ ਕੂੜਾ ਕਰਕਟ ਸਮੇਟਣ ਵਾਲੇ ਜੋ ਡੱਬਾ ਰੱਖਇਆ ਗਿਆ ਹੈ ਆਪ ਜੀ ਦੀ ਕੰਪਨੀ ਵੱਲੋਂ ਸਾਨੂੰ ਦਿੱਤਾ ਗਿਆ ਹੈ ਉਹ ਚੋਰੀ ਹੋ ਗਿਆ ਹੈ ਕਿਸੇ ਸ਼ਰਾਰਤੀ ਅਨਸਰ ਵੱਲੋਂ ਚੋਰੀ ਕਰ ਲਿਆ ਗਿਆ ਹੈ ਹੁਣ ਕੂੜੇ ਕਰਕਟ ਦੀ ਸੰਭਾਲ ਲਈ ਮੈਨੂੰ ਘਰ ਦੇ ਵਿੱਚ ਬੜੀ ਪ੍ਰੋਬਲਮ ਆ ਰਹੀ ਹੈ ਅਤੇ ਘਰ ਦੇ ਵਿੱਚੋਂ ਬੜੀ ਬਦਬੂ ਆ ਰਹੀ ਹੈ ਜਿਸ ਨਾ ਕਰਕੇ ਸਿਹਤ ਸਬੰਧੀ ਸਮੱਸਿਆਵਾਂ ਵੀ ਪੈਦਾ ਹੋ ਸਕਦੀਆਂ ਹਨ ਮੇਰੀ ਆਪ ਜੀ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਮੈਂਨੂੰ ਇੱਕ ਨਵਾਂ ਕੂੜਾ ਕਰਕਟ ਲਈ ਇੱਕ ਨਵਾਂ ਡੱਬਾ ਦੇ ਦਿੱਤਾ ਜਾਵੇ ਤਾਂ ਜੋ ਮੈਂ ਆਪਣੇ ਘਰ ਦੇ ਕੂੜੇ ਕਰਕਟ ਦੀ ਉਚਿਤ ਸੰਭਾਲ ਕਰਕੇ ਆਪ ਜੀ ਦੀ ਕੰਪਨੀ ਜੋ ਘਰੋਂ ਘਰੀ ਚੱਕ ਕੇ ਲੈ ਕੇ ਜਾਂਦੀ ਹੈ ਉਹਨਾਂ ਨੂੰ ਸਪੁਰਦ ਕਰ ਦੇਵਾਂ ਮੇਰੇ ਘਰ ਦਾ ਪਤਾ ਹੈ ਜੀ ਬੀ ਬਾਰਾਂ ਸਲੇਮ ਟਾਬਰੀ ਮਕਾ ਮਕਾਨ ਨੰਬਰ ਸੱਤ ਸੌ ਚੌਂਹਠ ਲੁਧਿਆਣਾ ਹੈ ਜੀ ਧੰਨਵਾਦ